ਹਾਂ ਪਹਿਲਾਂ ਮੈਂ ਚਿੱਤਰਕਾਰੀ ਕਰਦੀ ਕਰੀ ਹੈ ਉਸ ਸਮੇਂ ਮੈਂ ਤੇ ਮੈਨੂੰ ਬਹੁਤ ਹੀ ਸ਼ੌਕ ਸੀ ਚਿੱਤਰਕਾਰੀ ਕਰਨ ਦਾ ਪਰ ਹੁਣ ਮੇਰੀ ਉਮਰ ਜ਼ਿਆਦਾ ਹੋ ਗਈ ਹੈ ਜਿਸ ਕਾਰਨ ਮੇਰੇ ਤੋਂ ਸਫਾਈ ਵਿੱਚ ਚਿੱਤਰਕਾਰੀ ਨਹੀਂ ਬਣਦੀ ਪਰ ਉਸ ਸਮੇਂ 'ਤੇ ਮੈਂ ਬਹੁਤ ਹੀ ਸੋਹਣੀ ਚਿੱਤਰਕਾਰੀ ਕਰਦੀ ਸੀ ਜੋ ਹਰ ਕਿਸੇ ਨੂੰ ਬਹੁਤ ਵਧੀਆ ਲੱਗਦੀ ਸੀ ਅਤੇ ਮੈਂ ਚਿੱਤਰਕਾਰੀ ਕਰਨ ਤੋਂ ਬਹੁਤ ਕੁਝ ਅਨੁਭਵ ਵੀ ਕੀਤਾ ਸੀ ਜਿਸ ਨੇ ਮੈਨੂੰ ਜ਼ਿੰਦਗੀ ਵਿੱਚ ਬਹੁਤ ਅੱਗੇ ਵਧਾਇਆ ਉਸ ਸਮੇਂ 'ਤੇ ਮੈਂ ਆਪਣੀ ਚਿੱਤਰਕਾਰੀ ਬਣਾ ਕੇ ਵੇਚ ਵੇਚ ਵੀ ਦਿੰਦੀ ਸੀ